ਹੈਲੋ

ਹਾਂਜੀ ਓਕੇ ਮੈਮ ਗੁੱਡ ਈਵਨਿੰਗ ਮੈਮ ਸੋ ਮੈਂ ਇਹ ਜਾਣਨਾ ਚਾਹੁੰਦਾ ਸੀਗਾ ਕਿ ਵੀ ਤੁਸੀਂ ਜਿਹੜਾ ਇਹ ਅਤੇ ਕੀ ਇਹਦੇ 'ਚ ਕੀ ਕੁਛ ਐਕਟੀਵਿਟੀਜ਼ ਹੈਗੀਆਂ ਨੇ ਕੀ ਕੁਛ ਸਿਖਾਇਆ ਜਾ ਸਕਦਾ ਕੀ ਕੁਛ ਸਿਖਾ ਰਹੇ ਹੋ ਤੁਸੀਂ ਕਿਉਂਕਿ ਮੈਂ ਵੀ ਆਪਣੇ ਬੱਚੇ ਨੂੰ ਦਾਖਲ ਕਰਵਾਉਣ ਦੇ ਬਾਰੇ ਸੋਚ ਰਿਹਾ ਸੀਗਾ ਵੀ ਅਗਰ ਕੁਛ ਹੋ ਜਾਵੇ ਤਾਂ ਹਾਂਜੀ ਦੱਸੋ ਬੱਚਾ ਮੇਲ ਹੈ ਹੀ ਈਸ ਅਬਾਊਟ ਏਟ ਈਅਰਸ ਓਲਡ ਦੇਖੋ ਜੀ ਅੱਜ ਕੱਲ੍ਹ ਅਗਰ ਆਪਾਂ ਦੇਖੀਏ ਕਿ ਬੱਚਿਆਂ ਦਾ ਇੰਟਰਸਟ ਤਾਂ ਉਹ ਜਿਹੜੇ ਹੈ ਕਿ ਕ੍ਰਿਕਟ ਬਹੁਤ ਚੱਲਦੀ ਹੈ ਅਤੇ ਕ੍ਰਿਕਟ ਦਾ ਇੰਟਰਸਟ ਤਾਂ ਬਹੁਤ ਹੁੰਦਾ ਬੱਚਿਆਂ ਦਾ ਹਾਂ ਪਰ ਗੱਲ ਵੀ ਹੈ ਕਿ ਮਗਰ ਬੱਚੇ ਦੇ ਵਿੱਚ ਟੇਲੈਂਟ ਜਿਹੜੇ ਹੈ ਹੈ ਨਾ ਜੀ ਕੀ ਤੁਸੀਂ ਟੇਲੈਂਟ ਵੀ ਉਹਦੇ 'ਚ ਦੇਖੋਗੇ ਬੱਚੇ ਨੂੰ ਕਿੱਧਰ ਪਾਇਆ ਜਾਵੇ ਜਾਂ ਤੁਸੀਂ ਅਸੀਂ ਜੋ ਕਹਾਂਗੇ ਉੱਧਰ ਉਸ ਦੇ ਵਿੱਚ ਹੀ ਤੁਸੀਂ ਉਹਨੂੰ ਰੱਖੋਗੇ ਹਾਂ ਤਾਂ ਮਤਲਬ ਯਾਨੀ ਕਿ ਹਾਂਜੀ ਹਾਂਜੀ ਜੀ ਫਿਰੋਜ਼ਪੁਰ ਤੋਂ ਹੀ ਹਾਂ ਤਾਂ ਹੀ ਸੋਚਿਆ ਸੀਗਾ ਕਿ ਵੀ ਕੋਈ ਆਪਣੇ ਇੱਥੇ ਲੋਕਲ ਜਿਹੜਾ ਕੋਈ ਮਿਲ ਸਕਦਾ ਕੋਈ ਐਸਾ ਹੈ ਨਾ ਕਲੱਬ ਵਗੈਰਾ ਜਾਂ ਐਸੀ ਕੋਈ ਜਗ੍ਹਾ ਅਤੇ ਇਹ ਤੁਹਾਡੀ ਜਿਹੜੀ ਫੀਸ ਹੈ ਇਹ ਅਲੱਗ ਅਲੱਗ ਵਿੰਗਸ ਦੀ ਅਲੱਗ ਅਲੱਗ ਹੈ ਜਾਂ ਤੁਸੀਂ ਇੱਕ ਸੇਮ ਫੀਸ ਕਿੰਨੀ ਕੁ ਲਓਗੇ ਕਿਸ ਤਰ੍ਹਾਂ ਚਲੋ ਠੀਕ ਹੈ ਜੀ ਮੈਂ ਫਿਰ ਆਏ ਵਿੱਲ ਟਰਾਏ ਤਾਂ ਮੈਂ ਕੱਲ੍ਹ ਨੂੰ ਹੀ ਕੱਲ੍ਹ ਸ਼ਾਮ ਨੂੰ ਤੁਹਾਨੂੰ ਕਿੰਨੇ ਕੁ ਵਜੇ ਮਿਲ ਸਕਦਾ ਬਸ ਠੀਕ ਹੈ ਜੀ ਫਿਰ ਮੈਂ ਪੰਜ ਕੁ ਵਜੇ ਆਉਂਗਾ ਓਕੇ ਜੀ ਕੱਲ੍ਹ ਨੂੰ ਮੈਂ ਮਿਲਦਾ ਜੀ ਤੁਹਾਨੂੰ ਓਕੇ ਜੀ